ਹੈਲੋ ਸਤਿ ਸ਼੍ਰੀ ਅਕਾਲ ਜੀ ਹਾਂਜੀ ਕਿਆ ਸੇਵਾ ਕਰ ਸਕਦੇ ਜੀ ਅਸੀਂ ਤੁਹਾਡੀ ਮੋਹਾਲੀ ਤੋਂ ਬੋਲਦੇ ਹਾਂ ਅਸੀਂ ਅੱਛਾ ਸੱਤ ਫੇਸ ਮੋਹਾਲੀ ਅੱਛਾ ਜੀ ਅੱਛਾ ਅੱਛਾ ਕੈਸ਼ ਵਗੈਰਾ ਵੀ ਤਾਂ ਜੀ ਕੈਸ਼ ਅੱਛਾ ਜੀ ਅਤੇ ਇਹ ਬੈਗ ਆਮ ਬੈਗ ਹੈ ਜਾਂ ਟਰਾਲੀ ਵਾਲਾ ਬੈਗ ਹੈ ਜੀ ਟਰਾਲੀ ਬੈਗ ਇੱਕ ਟਰਾਲੀ ਬੈਗ ਹੁੰਦਾ ਇੱਕ ਤਾਂ ਆਮ ਅੱਛਾ ਜੀ ਇਹਦੇ ਵਿੱਚ ਤੁਹਾਡਾ ਪਾਸਪੋਰਟ ਵਗੈਰਾ ਵੀ ਹੋਵੇਗਾ ਠੀਕ ਹੈ ਜੀ ਅਤੇ ਤੁਹਾਡੀ ਕੰਪਲੇਂਟ ਅਸੀਂ ਲਿਖ ਲਈ ਹੈ ਬਾਕੀ ਹੁਣ ਤੁਸੀਂ ਸੱਤ ਫੇਸ ਦੇ ਵਿੱਚ ਹੈ ਜਾਂ ਆਪਣੇ ਘਰ ਪਹੁੰਚ ਗਏ

ਠੀਕ ਹੈ ਜੀ ਠੀਕ ਹੈ ਅਤੇ ਤੁਸੀਂ ਮਤਲਬ ਨ ਫੋਨ ਨੰਬਰ ਇਹ ਹੀ ਚਲਦਾ ਜਿਹੜਾ ਤੁਸੀਂ ਮੈਨੂੰ ਕਾਲ ਕਰ ਰਹੇ ਹੋ ਠੀਕ ਹਾਂ ਜੀ ਹਾਂ ਜ ਅਤੇ ਅਤੇ ਆਪਣਾ ਬੈਗ ਦਾ ਰੰਗ ਕਾਲਾ ਠੀਕ ਹੈ ਜੀ ਬਾਕੀ ਤੁਹਾਡੀ ਕੰਪਲੇਂਟ ਅਸੀਂ ਲਿਖ ਲਈ ਹੈ ਅਤੇ ਜਦੋਂ ਵੀ ਇਹਦੇ ਬਾਰੇ ਕੋਈ ਇਨਫੋਰਮੇਸ਼ਨ ਆਉਂਦੀ ਹੈ ਤਾਂ ਤੁਹਾਨੂੰ ਇਹ ਫੋਨ 'ਤੇ ਕੰਟੈਕਟ ਕੀਤਾ ਜਾਵੇਗਾ ਹਾਂਜੀ ਇਹ ਤੋਂ ਇਲਾਵਾ ਹੋਰ ਸੇਵਾ ਦੱਸੋ ਜੀ ਕੋਈ ਆਪਣਾ ਸੇਵਾ ਸੇਵਾਦਾਰ ਹੈ ਜੀ ਹਾਂ ਮੋਹਾਲੀ ਦੇ ਵਿੱਚ ਹਾਂਜੀ ਠੀਕ ਹੈ ਜੀ ਧੰਨਵਾਦ ਠੀਕ ਹੈ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ